ਸਾਡੇ ਪਿੰਡਾਂ ਵਿੱਚ ਜੋ ਸ਼ਡਿਊਲ ਕਾਸਟ ਅਤੇ ਸ਼ਡਿਊਲ ਟਰਾਈਵ ਪੱਛੜੀਆਂ ਸ਼੍ਰੇਣੀਆਂ ਦੇ ਲੋਕ ਹਨ ਉਹਨਾਂ ਨੂੰ ਸਹੂਲਤਾਂ ਨਾ ਹੋਣ ਕਰਕੇ ਉਹ ਬੜੇ ਪਰੇਸ਼ਾਨ ਹਨ ਅਤੇ ਕੋਈ ਇਹੋ ਜਿਹਾ ਧਰਮ ਚਾਹੁੰਦੇ ਹਨ ਜੋ ਕਿ ਉਹਨਾਂ ਨੂੰ ਸਹੂਲਤਾਂ ਦੇ ਸਕੇ ਅਤੇ ਉਹਨਾਂ ਦੀ ਗਰੀਬੀ ਦੂਰ ਕਰ ਸਕੇ ਇਸ ਕਰਕੇ ਉਹ ਈਸਾਈ ਈਸਾਈ ਮੱਤ ਕ੍ਰਿਸਚਨ ਕ੍ਰਿਸਚਨ ਜੋ ਕਿ ਅੱਜ ਕੱਲ੍ਹ ਬੜਾ ਫੈਲ ਰਿਹਾ ਹੈ ਅਤੇ ਉਹ ਆਪਣੇ ਲਿਟਰੇਚਰ ਨੂੰ ਫਰੀ ਵੰਡਦਾ ਹੈ ਅਤੇ ਆਪਣਾ ਸਹੂਲਤਾਂ ਸਾਰ ਅਤੇ ਹਰ ਪ੍ਰਕਾਰ ਦੀਆਂ ਸਹੂਲਤਾਂ ਦਿੰਦਾ ਹੈ ਜਿਵੇਂ ਕਿ ਬੱਚਿਆਂ ਨੂੰ ਮੁਫਤ ਪੜ੍ਹਾਈ ਦੇਣਾ ਉਹਨਾਂ ਦੇ ਉਹਨਾਂ ਦੇ ਉਹਨਾਂ ਉਹਨਾਂ ਵਾਸਤੇ ਨੌਕਰੀਆਂ ਮੁਹੱਈਆ ਕਰਵਾਉਣੀਆਂ ਉਹਨਾਂ ਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਦੇਣੀ ਇਸ ਕਰਕੇ ਪਿੰਡਾਂ ਦੇ ਲੋਕ ਸਿੱਖ ਧਰਮ ਜਾਂ ਹਿੰਦੂ ਧਰਮ ਨੂੰ ਛੱਡ ਕੇ ਈਸਾਈ ਧਰਮ ਵੱਲ ਖਿੱਚੇ ਜਾ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਉੱਥੇ ਸਾਨੂੰ ਪੂਰਾ ਪੂਰਾ ਫਾਇਦਾ ਮਿਲਦਾ ਮਿਲ ਰਿਹਾ ਹੈ ਅਤੇ ਸਾਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀ ਮਿਲਦੀਆਂ ਹਨ ਇਸ ਕਰਕੇ ਉਹ ਆਪਣਾ ਧਰਮ ਕਨਵਰਟ ਕਰਕੇ ਉੱਧਰ ਜਾ ਰਹੇ ਹਨ ਅਤੇ ਆਪਣਾ ਜਿਹੜਾ ਹਿੰਦੂ ਧਰਮ ਜਾਂ ਸਿੱਖ ਧਰਮ ਹੈ ਉਹਨੂੰ ਛੱਡ ਰਹੇ ਹਨ ਇਹ ਹਿੰਦੂ ਸਿੱਖਾਂ ਵਾਸਤੇ ਬੜੀ ਚੁਣੌਤੀ ਹੈ ਥੈਂਕ ਯੂ